ਵੈਸੇ ਤਾਂ ਗੱਲ ਕੀਤੀ ਜਾਵੇ ਕਿ ਮੈਂ ਬਹੁਤ ਹੀ ਮੂਰਤੀਆਂ ਕਲਾ ਬਣਾਈਆਂ ਹੈਗੀਆਂ ਹੈ ਆ ਜੇ ਕਿ ਵੀ ਜਿਵੇਂ ਕਿ ਪਰ ਮੈਨੂੰ ਸਭ ਤੋਂ ਜ਼ਿਆਦਾ ਬੈਸਟ ਮੇਰੀ ਬਚਪਨ ਦੀ ਕਲਾ ਲੱਗਦੀ ਹੈ ਮੈਂ ਆਪਣੇ ਬਚਪਨ ਦੇ ਵਿੱਚ ਇੱਕ ਨਾ ਚਿੱਕੜ ਇਕੱਠਾ ਕਰਕੇ ਮੋਬਾਇਲ ਬਣਾਇਆ ਸੀ ਕਿਉਂਕਿ ਮੇਰੇ ਸਾਰੇ ਦੋਸਤਾਂ ਦੇ ਕੋਲ ਮੋਬਾਇਲ ਸਨ ਅਤੇ ਮੇਰੇ ਕੋਲ ਮੋਬਾਇਲ ਨਹੀਂ ਸੀ ਜਿਵੇਂ ਕਿ ਤੁਸੀਂ ਜਾਣਦੇ ਹੋ ਬਚਪਨ ਦੇ ਵਿੱਚ ਹਮੇਸ਼ਾ ਬ ਬੱਚਾ ਕੁਛ ਨਾ ਕੁਛ ਕਰਦਾ ਹੀ ਹੈ ਸ਼ਰਾਰਤਾਂ ਅਤੇ ਮੈਂ ਵੀ ਇੱਕ ਬਚਪਨ ਦੇ ਵਿੱਚ ਮੋਬਾਇਲ ਦਾ ਸ਼ੌਕ ਰੱਖਿਆ ਸੀ ਅਤੇ ਮੈਂ ਚਿੱਕੜ ਦਾ ਮੋਬਾਇਲ ਬਣਾ ਕੇ ਉਸ ਦੇ ਉੱਪਰ ਆਪਣੇ ਹੱਥਾਂ ਦੇ ਨਾਲ ਸਕਰੀਨ ਬਣਾਈ ਉਸ ਦੇ ਆਪਣੇ ਹੱਥਾਂ ਦੇ ਨਾਲ ਇੱਕ ਛੋਟੀ ਸੀ ਡੰਡੀ ਲੈ ਕੇ ਆਪਣੀ ਮੈਂ ਸਕਰੀ ਸਕਰੀਨ ਬਣਾਈ ਅਤੇ ਕੀਪੈਡ ਬਣਾਏ ਇੱਕ ਤੋਂ ਲੈ ਕੇ ਨੋਂ ਤੱਕ ਜ਼ੀਰੋ ਸਟਾਰ ਹੈਸ਼ ਅਤੇ ਉਹਨੂੰ ਬਹੁਤ ਵਧੀਆ ਹੀ ਸ਼ੇਪ ਦਿੱਤੀ ਸੀ